ਸਾਡੇ ਸਕੂਲਾਂ ਵਿੱਚ ਇਤਿਹਾਸ ਤਾਂ ਪੜ੍ਹਾਇਆ ਜਾਂਦਾ ਸੀਗਾ ਪਰ ਬਹੁਤ ਹੀ ਡੀਪਲੀ ਸਾਨੂੰ ਨਹੀਂ ਸੀ ਦੱਸਿਆ ਜਾਂਦਾ ਸਾਨੂੰ ਬਸ ਕਾਪੀ 'ਤੇ ਲੇਖ ਲਿਖਣ ਨੂੰ ਦੇ ਦੇਣੇ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਗਏ ਜਿਵੇਂ ਹੈ ਨਾ ਸ਼ਹੀਦ ਉਧਮ ਸਿੰਘ ਹੋ ਗਿਆ ਰਾਜਗੁਰੂ ਹੋ ਗਿਆ ਸੁਖਦੇਵ ਹੋ ਗਿਆ ਸ਼ਹੀਦ ਭਗਤ ਸਿੰਘ ਹੋ ਗਿਆ ਇਹਨਾਂ ਬਾਰੇ ਕਹਿ ਤਾਂ ਦੇਣਾ ਸਾਨੂੰ ਕਿ ਲੇਖ ਲਿਖ ਲਓ ਤੁਹਾਨੂੰ ਪੇਪਰਾਂ 'ਚ ਆਉਣੇ ਆ ਪਰ ਉਹਨਾਂ ਲਈ ਡੀਪਲੀ ਨਹੀਂ ਸੀ ਸਾਨੂੰ ਦੱਸਿਆ ਜਾਂਦਾ ਕਿ ਉਹਨਾਂ ਨੇ ਕੀਤਾ ਕੀ ਸੀ ਸਾਡੇ ਲਈ ਹੈ ਨਾ ਕੀ ਇਤਿਹਾਸ ਸੀ ਉਹਨਾਂ ਦਾ ਬਹੁਤ ਘੱਟ ਪੜ੍ਹਾਇਆ ਜਾਂਦਾ ਸੀ ਪਰ ਇਹਨਾਂ ਜ਼ਿਆਦਾਤਰ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ ਸੀ ਇਹਨਾਂ ਚੀਜ਼ਾਂ 'ਤੇ ਕੀ ਹੈ ਨਾ ਜਿੱਦਾਂ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਡੇ ਪਹਿਲੇ ਗੁਰੂ ਆ ਹੈ ਨਾ ਉਹਨਾਂ ਨੇ ਕੀ ਕੀ ਕੀਤਾ ਸਾਡੇ ਲਈ ਸਭ ਕੁਝ ਦੱਸਣਾ ਚਾਹੀਦਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਦੱਸਣਾ ਚਾਹੀਦਾ ਸੀ ਜਿਵੇਂ ਉਹ ਸਾਡੇ ਦਸਵੇਂ ਗੁਰੂ ਹੈ ਹੈ ਨਾ ਉਹਨਾਂ ਨੇ ਕੀ ਕੀ ਕੀਤਾ ਸਾਡੇ ਲਈ ਸਭ ਕੁਝ ਦੱਸਣਾ ਚਾਹੀਦਾ ਸੀ ਇਹਨਾਂ ਨੂੰ ਅਤੇ ਜਿਹੜਾ ਇਹ ਜਿਹਨਾਂ ਨੇ ਸਾਨੂੰ ਦੇਸ਼ ਆਜ਼ਾਦ ਕਰਨ ਲਈ ਸ਼ਹੀਦੀਆਂ ਪਾਈਆਂ ਸੀ ਉਹਨਾਂ ਦੇ ਬਾਰੇ ਵੀ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਦੇਣੀ ਚਾਹੀਦੀ ਸੀ ਜਿੱਦਾਂ ਤੁਹਾਨੂੰ ਪਤਾ ਲੱਗਦਾ ਹੁੰਦਾ ਸੀ ਕਿ ਕਿਵੇਂ ਕਿਹਨੇ ਕਿਹਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੀ ਕੀ ਕੀਤਾ ਹੈ ਨਾ ਅਤੇ ਜਿਵੇਂ ਇਹਨਾਂ ਚੀਜ਼ਾਂ ਬਾਰੇ ਸਕੂਲ 'ਚ ਸਾਰੇ ਟੀਚਰਸ ਨੂੰ ਗੌਰ ਕਰਨੀ ਚਾਹੀਦੀ ਸੀ ਕਿ ਸਾਨੂੰ ਜਿਹੜਾ ਇਹਨਾਂ ਚੀਜ਼ਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਵੇ ਇਕੱਲਾ ਲੇਖ ਹੀ ਨਹੀਂ ਹੈ ਕਿ ਲੇਖ ਲਿਖਾ ਦਿੱਤਾ ਅਤੇ ਪੜ੍ਹਾ ਲਿਆ ਉਹੀ ਉਹੀ ਨਹੀਂ ਮਾਇਨੇ ਰੱਖਦਾ ਇਹਨਾਂ ਬਾਰੇ ਡੀਪਲੀ ਸਮਝਾਉਣਾ ਵੀ ਬਹੁਤ ਮਾਇਨੇ ਰੱਖਦਾ ਹੁੰਦਾ ਸੀ